ਮੇਰਾ ਭਰਾ ਇੱਕ ਦਿਨ ਬਿਮਾਰ ਸੀ ਇਸ ਲਈ ਮੇਰੀ ਮੰਮੀ ਨੇ ਉਹਨਾਂ ਨੂੰ ਉਹਨੂੰ ਖਿਚੜੀ ਬਣਾ ਕੇ ਦਿੱਤੀ ਖਿਚੜੀ ਅਤੇ ਦਲੀਆ ਬਣਾ ਕੇ ਦਿੱਤਾ ਬਹੁਤ ਹੀ ਉਸਨੂੰ ਬਹੁਤ ਹੀ ਸਿਹਤਮੰਦ ਰਿਹਾ ਜਦੋਂ ਉਸਨੂੰ ਅਸੀਂ ਰੋਟੀ ਦਿੰਦੇ ਹਨ ਦਿੰਦੇ ਸੀ ਤਾਂ ਉਹ ਬਿਮਾਰ ਹੋਰ ਜ਼ਿਆਦਾ ਹੋ ਜਾਂਦਾ ਸੀ ਇਸ ਕਰਕੇ ਉਸ ਨੂੰ ਤਿੰਨ ਚਾਰ ਦਿਨ ਅਸੀਂ ਖਿਚੜੀ ਅਤੇ ਦਲੀਆ ਹੀ ਬਣਾ ਕੇ ਦਿੱਤਾ ਉਹ ਉਸਦੀ ਸਿਹਤ ਵਿਚ ਬਹੁਤ ਜ਼ਿਆਦਾ ਸੁਧਾਰ ਆ ਗਿਆ ਸੀ